ਹੈਲੋ ਸਤਿ ਸ਼੍ਰੀ ਅਕਾਲ ਮੈਡਮ ਮੈਡਮ ਕਮਲਪ੍ਰੀਤ ਕੌਰ ਬੋਲ ਰਹੇ ਹੋ ਮੈਂ ਨਾ ਡਾਟਾ ਕਲੈਕਟ ਕਰਨਾ ਸੀ ਅਤੇ ਮੈਨੂੰ ਤੁਹਾਡਾ ਮਿਲਿਆ ਤਾਂ ਮੈਂ ਤੁਹਾਨੂੰ ਕਾਲ ਕੀਤੀ ਹੈ ਅਤੇ ਮੈਨੂੰ ਕੁਝ ਡਾਟਾ ਚਾਹੀਦਾ ਸੀ ਤੁਹਾਡੇ ਤੋਂ ਮੈਂ ਨਾ ਆਪਣੇ ਪ੍ਰੋਜੈਕਟ ਲਈ ਕੁਲੈਕਟ ਕਰਨਾ ਇਹ ਡਾਟਾ ਹਾਂਜੀ ਮੈਂ ਨਾ ਇਹ ਜਾਨਣਾ ਚਾਹੁੰਦੀ ਹੈ ਜਿਵੇਂ ਕਿ ਕਿੰਨੀ ਕੁ ਡਿਵੈਲਪਮੈਂਟ ਆਈ ਹੈ ਉਸ ਰੀਜਨ 'ਚ ਨੋਰਥ ਰੀਜਨ 'ਚ ਜਿਵੇਂ ਐਜੂਕੇਸ਼ਨ ਵੱਲ ਕੀ ਕੀ ਚੇਂਜਿਸ ਤਾਂ ਆਏ ਨੇ ਪਹਿਲਾਂ ਨਾਲੋਂ ਵੀ ਹੁਣ ਕੀ ਚੇਂਜ ਆਏ ਆ ਕੁਛ ਮਤਲਬ ਮੈਂ ਡਿਵੈਲਪਮੈਂਟ ਜਾਨਣਾ ਚਾਹੁੰਦੀ ਹਾਂ ਦੱਸੋਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਠੀਕ ਹੈ ਮੈਡਮ ਸਭ ਕੁਛ ਔਨਲਾਈਨ ਵਾਲਾ ਉਪਲੱਬਧ ਹੈ ਇੱਥੇ ਵੀ ਬੱਚੇ ਉਹ ਫਿਲਟੀ ਪ੍ਰੋਵਾਈਡ ਹੁੰਦੀ ਉਹਨਾਂ ਨੂੰ

ਅੱਛਾ ਅਤੇ ਉੱਦਾਂ ਨੈਟਵਰਕ ਦੀ ਪ੍ਰੋਬਲਮ ਤਾਂ ਨਹੀਂ ਕੋਈ ਆਉਂਦੀ ਤੁਹਾਡੇ ਰੀਜਨ 'ਚ ਜਿੱਦਾਂ ਔਫ ਔਨਲਾਈਨ ਹੋਣ ਦੀਆਂ ਨੇ ਬੱਚਿਆਂ ਕੋਲ ਜਿਵੇਂ ਉਹ ਮੋਬਾਈਲ ਐਪਸ ਹੁੰਦੀਆਂ ਉਹ ਚਲਾ ਰਹੇ ਨੇ ਜਿਵੇਂ ਉਹਨਾਂ ਦੀ ਸੈਸਫਿਕ ਇੱਕ ਸਕੂਲ ਦੀ ਐਪ ਹੁੰਦੀ ਹੈ ਜ਼ਰੂਰ ਵਿਜਿਟ ਕਰਾਂਗੇ ਮੈਡਮ ਜਦੋਂ ਟਾਈਮ ਲੱਗਿਆ ਤਾਂ ਹੋਰ ਤੁਸੀਂ ਦੱਸੋ ਵੀ ਜਿਵੇਂ ਛੋਟੇ ਬੱਚੇ ਆ ਉਹਨਾਂ ਲਈ ਕੋਈ ਪ੍ਰੀਸਕੂਲ ਹੁੰਦੇ ਆ ਕਿਉਂਕਿ ਅੱਜ ਕੱਲ੍ਹ ਜੇ ਬ ਹਾਂ ਕਿਉਂਕਿ ਅੱਜ ਕੱਲ੍ਹ ਪੇਰੈਂਟਸ ਜਿਵੇ ਦੋਨੋਂ ਵਰਕਿੰਗ ਹੁੰਦੇ ਆ ਅਤੇ ਉਹਨਾਂ ਦੀ ਜਿਵੇਂ ਛੋਟੇ ਬੱਚੇ ਆ ਨਾਲੇ ਤਾਂ ਉਹ ਐਜੂਕੇਸ਼ਨ ਲੈ ਰਹੇ ਹੁੰਦੇ ਨਾਲੇ ਕੇਅਰਿੰਗ ਵਾਲਾ ਹੁੰਦਾ ਇੱਦਾਂ ਦਾ ਕੋਈ ਸਿਸਟਮ ਮਤਲਬ ਜਿਵੇਂ ਕੋਈ ਤੁਹਾਡੀ ਜਿੱਥੇ ਤੁਸੀਂ ਕਹਿੰਦੇ ਸੈਂਟਰ ਯੂਨੀਵਰਸਿਟੀ 'ਚ ਕੰਮ ਕਰਦੇ ਕੁਝ ਹੈ ਇੱਦਾਂ ਦਾ ਓਕੇ ਮੈਡਮ ਯੇ ਤੋ ਬਹੁਤ ਵਧੀਆ ਗੱਲ ਹੈ ਮੈਨੂੰ ਪ੍ਰੋਜੈਕਟ ਲਈ ਡਾਟਾ ਵੀ ਕਲੈਕਟ ਹੋ ਗਿਆ ਥੈਂਕ ਯੂ ਮੈਮ ਅਗਰ ਫਿਰ ਲੋੜ ਪਈ ਮੈਂ ਤੁਹਾਨੂੰ ਫਿਰ ਕਾਲ ਕਰਾਂਗੀ ਓਕੇ ਥੈਂਕ ਯੂ ਮੈਮ